ਹੈਲੋ ਸਤਿ ਸ਼੍ਰੀ ਅਕਾਲ ਜੀ ਪੰਜਾਬ ਬੂਟੀਕ ਤੋਂ ਬੋਲ ਰਹੇ ਗੁਰਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਪੰਜਾਬੀ ਸੂਟ ਸਿਲਵਾਉਣਾ ਸੀ ਥੋਤੋਂ ਹੀ ਸਾਡੇ ਨਾ ਫੰਕਸ਼ਨ ਹੈ ਉਹਦੇ ਕਰਕੇ ਮੈਨੂੰ ਪੰਜਾਬੀ ਲੁੱਕ ਚਾਹੀਦੀ ਹੈ ਜੀ ਅਤੇ ਕੀ ਤੁਹਾਡਾ ਕੀ ਪਰਾਇਜ਼ ਮੈਨੂੰ ਚਾਹੀਦਾ ਅੱਗੇ ਦਸ ਦਿਨ ਤੱਕ ਚਾਹੀਦਾ ਹੈ ਜੀ ਇਸ ਸੰਨਡੇ ਤੋਂ ਅਗਲੇ ਸੰਨਡੇ ਚਾਹੀਦੇ ਹੈ ਜੀ ਅਤੇ ਕੀ ਪਰਾਇਜ਼ ਹੈ ਜੀ ਨੌਰਮਲ ਸੂਟ ਦਾ ਅੱਛਾ ਅਤੇ ਅੱਛਾ ਜੀ ਠੀਕ ਹੈ ਠੀਕ ਹੈ ਅਤੇ ਠੀਕ ਹੈ ਮਿਲ ਜਾਵੇਗਾ ਟਾਇਮ ਸਿਰ ਮਿਲ ਜਾਵੇਗਾ ਜੀ ਸੂਟ ਹੈ ਮੈਂ ਨਾ ਪਟਿਆਲਾ ਸ਼ਾਹੀ ਸਲਵਾਰ ਬਣਾਉਣੀ ਹੈ ਇੱਕ ਐਨ ਵਧੀਆ ਪੰਜਾਬੀ ਲੁੱਕ ਚਾਹੀਦਾ ਜੀ ਮੈਨੂੰ ਠੀਕ ਹੈ ਨਾ ਅਤੇ ਹਾਂਜੀ ਹਾਂ ਨਾ ਕੱਪੜਾ ਹਾਂਜੀ ਠੀਕ ਹੈ ਅਤੇ ਫਿਰ ਮੈਂ ਅੱਜ ਸ਼ਾਮ ਨੂੰ ਆਊਂਗੀ ਤੁਹਾਡੀ ਸ਼ੌਪ 'ਤੇ ਕਿੰਨੇ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਜੀ ਤੁਹਾਡੀ ਸ਼ੌਪ ਸੱਤ ਵਜੇ ਤੱਕ ਠੀਕ ਹੈ ਜੀ ਫੇਰ ਮੈਂ ਸੱਤ ਵਜੇ ਪੰਜ ਪੰਜ ਕੁ ਵਜੇ ਆ ਜਾਵਾਂਗੀ ਜੀ ਮੈਂ ਠੀਕ ਹੈ ਜੀ ਧੰਨਵਾਦ